ਦਸਤ ਦੇ ਇਲਾਜ ਦੇ ਨੁਸਖ਼ੇ ਇਸ ਪ੍ਰਕਾਰ ਹਨ ਨਮਕ ਖੰਡ ਦਾ ਘੋਲ ਪੀਣ ਨਾਲ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ ਇਸ ਦੇ ਲਈ ਪਾਣੀ ਨੂੰ ਉਬਾਲੋ ਜਦੋਂ ਇਹ ਥੋੜ੍ਹਾ ਠੰਡਾ ਹੋ ਜਾਵੇ ਤਾਂ ਇਸ ਵਿੱਚ ਬਰਾਬਰ ਮਾਤਰਾ ਵਿੱਚ ਚੀਨੀ ਅਤੇ ਨਮਕ ਮਿਲਾ ਕੇ ਪੀਓ ਅਨਾਰ ਦਾ ਜੂਸ ਜਾਂ ਫਲ ਅਨਾਰ ਵਿੱਚ ਐਂਟੀ ਫਿਲੇਮੈਂਟਰੀ ਗੁਣ ਹੁੰਦੇ ਹਨ ਜੋ ਦਸਤ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਨਿੰਬੂ ਦਾ ਰਸ ਪੀਓ ਜੀਰੇ ਦਾ ਕਾੜਾ ਪੀਓ ਇਕ ਲੀਟਰ ਪਾਣੀ ਵਿੱਚ ਇਕ ਚਮਚ ਜੀਰਾ ਪਾ ਕੇ ਉਬਾਲ ਲਓ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਠੰਡਾ ਕਰਕੇ ਥੋੜ੍ਹਾ ਜਿਹਾ ਪਾ ਦਿਓ